ਪੰਜਾਬ ਵਿੱਚ ਹੁਣ ਸਿਹਤ ਸੰਭਾਲ ਟੈਕਨੋਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ ਪਹਿਲਾਂ ਜੋ ਕਿ ਐਨੀ ਟੈਕਨੋਲੋਜੀ ਨਹੀਂ ਸੀ ਹਾਰਟ ਦੇ ਓਪਰੇਸ਼ਨ ਵਗੈਰਾ ਕਰਨੇ ਹੁੰਦੇ ਸੀ ਤਾਂ ਉਸ ਵਿੱਚ ਵੀ ਮਸ਼ੀਨਾਂ ਨਹੀਂ ਸਨ ਅਤੇ ਵਧੀਆ ਡਾਕਟਰ ਵੀ ਨਹੀਂ ਸਨ ਜਿਸ ਕਰਕੇ ਪੇਸ਼ੈਂਟਸ ਨੂੰ ਬਹੁਤ ਪ੍ਰੋਬਲਮਸ ਆ ਰਹੀ ਸੀ ਅਤੇ ਇਹਨਾਂ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਲੇਕਿਨ ਪਰ ਹੁਣ ਧੀਰੇ ਧੀਰੇ ਹਰਟ ਦੀਆਂ ਬਹੁਤ ਸਾਰੀਆਂ ਮਸ਼ੀਨਾਂ ਆ ਗਈਆਂ ਹਨ ਡਾਕਟਰ ਵੀ ਕਾਫੀ ਵੱਡੇ ਵੱਡੇ ਡਾਕਟਰ ਪੰਜਾਬ ਵਿੱਚ ਹਨ ਜੋ ਕਿ ਜੋ ਕਿ ਹਾਰਟ ਦਾ ਹਰ ਤਰ੍ਹਾਂ ਦਾ ਓਪਰੇਸ਼ਨ ਬਹੁਤ ਆਸਾਨੀ ਨਾਲ ਕਰਕੇ ਮਰੀਜ਼ਾਂ ਨੂੰ ਬਹੁਤ ਲਾਭ ਪਹੁੰਚਾ ਰਹੇ ਹਨ ਹੁਣ ਹੋਸਪਿਟਲ ਵਿੱਚ ਮੈਡੀਕਲ ਰਿਕੋਡ ਰੱਖਣ ਵਾਸਤੇ ਬਹੁਤ ਸਾਰੇ ਕੰਪਿਊਟਰਾਈਜ਼ ਸਿਸਟਮ ਸ਼ੁਰੂ ਕਰ ਦਿੱਤੇ ਹਨ ਜਿੱਥੇ ਕਿ ਮੈਡੀਕਲ ਦਾ ਰਿਕੋਡ ਬਹੁਤ ਆਰਾਮ ਨਾਲ ਰੱਖਿਆ ਜਾ ਸਕਦਾ ਹੈ ਅਤੇ ਉਸਨੂੰ ਮੈਨਟੇਨ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਹੋਸਪਿਟਲ ਦੀਆਂ ਫੈਸਲਿਟੀਆਂ ਜੋ ਹੈ ਉਹ ਅੱਗੇ ਨਾਲੋਂ ਪੰਜਾਬ ਵਿੱਚ ਵੱਧ ਹੋ ਗਈਆਂ ਹਨ ਪੰਜਾਬ ਵਿੱਚ ਬਹੁਤ ਬਹੁਤ ਹੀ ਸੁਵਿਧਾਵਾਂ ਜੋ ਹੈ ਉਹ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਅਤੇ ਜੋ ਵੀ ਮਰੀਜ਼ ਦਾ ਰਿਕੋਡ ਹੈ ਉਹ ਹਰ ਤਰ੍ਹਾਂ ਦਾ ਰਿਕੋਡ ਅਤੇ ਉਹਨਾਂ ਉ ਉਸਨੂੰ ਕੰਪਿਊਟਰ 'ਤੇ ਸਿਸਟਮ 'ਤੇ ਸੈੱਟ ਕਰਕੇ ਰੱਖਿਆ ਜਾ ਰਿਹਾ ਹੈ ਤਾਂ ਜੋ ਮਰੀਜ਼ਾਂ ਨੂੰ ਨੂੰ ਕਿਸੇ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕੀਤਾ ਜਾਵੇ ਅਤੇ ਸਰਕਾਰ ਤਰਫੋਂ ਵੀ ਮਰੀਜ਼ਾਂ ਨੂੰ ਬਹੁਤ ਸਾਰੀਆਂ ਫੈਸਲਿਟੀਆਂ 'ਤੇ ਫਰੀ ਇਲਾਜ ਦਿੱਤਾ ਜਾ ਰਿਹਾ ਹੈ ਇਸ ਕਰਕੇ ਪੰਜਾਬ ਵਿੱਚ ਸਿਹਤ ਸੰਭਾਲ ਦੀ ਟੈਕਨੋਲੋਜੀ ਵਿੱਚ ਬਹੁਤ ਵਾਧਾ ਹੋਇਆ ਹੈ